ਹਾਂ ਮੈਂ ਪੈੱਨ ਨਾਲ ਕਾਗਜ਼ 'ਤੇ ਲਿਖਣਾ ਪਸੰਦ ਕਰਦੀ ਹਾਂ ਕਿਉਂਕਿ ਪੈੱਨ ਨਾਲ ਲਿਖਣ ਦਾ ਮਜ਼ਾ ਹੀ ਕੁਝ ਹੋਰ ਹੈ ਜਿਸ ਨਾਲ ਹੱਥਾਂ ਦੀ ਪ੍ਰੈਕਟਿਸ ਵੀ ਵਧੀਆ ਹੁੰਦੀ ਹੈ ਅਤੇ ਟਾਈਮ ਵੀ ਵਧੀਆ ਨਿਕਲ ਜਾਂਦਾ ਹੈ ਫਾਲਤੂ ਪਾਸੇ ਧਿਆਨ ਨਹੀਂ ਜਾਂਦਾ ਹੱਥ ਲਿਖਤ ਇੱਕ ਯਾਦਗਾਰ ਬਣ ਜਾਂਦੀ ਹੈ ਜਿਸ ਨਾਲ ਕੋਈ ਨੋਟਿਸ ਮੈਨੂੰ ਪਿਛਲੇ ਪਲ ਯਾਦ ਕਰਵਾਉਂਦੇ ਰਹਿੰਦੇ ਹਨ ਕਈ ਵਾਰ ਮੈਂ ਆਪਣਾ ਅਭਿਆਸ ਕਾਗਜ਼ਾਂ ਉੱਪਰ ਨੋਟ ਕੀਤਾ ਹੁੰਦਾ ਹੈ ਯਾਦ ਸ਼ਕਤੀ ਬਣੀ ਰਹਿੰਦੀ ਹੈ ਹਾਂ ਮੈਂ ਮੋਬਾਈਲ ਅਤੇ ਕੰਪਿਊਟਰ ਲੈਪਟੋਪ 'ਤੇ ਵੀ ਟਾਈਪਿੰਗ ਕਰਦੀ ਹਾਂ ਲੋੜ ਅਨੁਸਾਰ ਇਹਨਾਂ 'ਤੇ ਡਾਟਾ ਸੇਵ ਤਾਂ ਕਰ ਸਕਦੇ ਹਾਂ ਪਰ ਕੋਈ ਖ਼ਰਾਬੀ ਆਉਣ 'ਤੇ ਅਸੀਂ ਦੁਬਾਰਾ ਦੇਖ ਨਹੀਂ ਸਕਦੇ ਅੱਜ ਦਾ ਯੁੱਗ ਕੰਪਿਊਟਰ ਅਤੇ ਮੋਬਾਇਲ ਦਾ ਯੁੱਗ ਹੈ ਜ਼ਿਆਦਾਤਰ ਸਮਾਂ ਨਾ ਦੇਣ ਕਾਰਨ ਹਰ ਕੋਈ ਕੰਪਿਊਟਰ ਅਤੇ ਮੋਬਾਇਲ 'ਤੇ ਟਾਈਪਿੰਗ ਕਰਦਾ ਕਰਨਾ ਪਸੰਦ ਕਰਦਾ ਹੈ ਇਹਨਾਂ ਕਾਰਨਾਂ ਕਰਕੇ ਇਹ ਹੱਥ ਲਿਖਤ ਰੁਝਾਨ ਥੋੜ੍ਹਾ ਬਦਲ ਗਿਆ ਹੈ